ਜਿੱਦਾਂ ਕਿ ਪੰਜਾਬ ਦਾ ਲੋਕ ਨਾਚ ਮੁੱਖ ਭੰਗੜਾ ਤਾਂ ਇਸੇ ਤਰ੍ਹਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਭੰਗੜਾ ਜਿਹੜਾ ਐਰੋਬਿਕਸ ਨੂੰ ਮਾਨਸਿਕ ਸਿਹਤ ਜੇ ਜਿੱਦਾਂ ਕੀ ਕਿਸੇ ਵਿਅਕਤੀ ਨੂੰ ਕੋਈ ਦੁੱਖ ਹੋਵੇ ਜਾਂ ਕੋਈ ਕਿਸੇ ਵੀ ਗੱਲ ਦੀ ਫਿਕਰ ਹੋਵੇ ਤਾਂ ਜੇ ਉਹ ਭੰਗੜਾ ਕਰਦਾ ਤਾਂ ਭੰਗੜੇ ਨਾਲ ਉਸਦਾ ਸਟਰੈਸ ਰਿਲੀਫ ਹੁੰਦਾ ਉਹ ਸਭ ਕੁਝ ਇੱਕ ਤਰ੍ਹਾਂ ਨਾਲ ਭੁੱਲ ਜਾਂਦਾ ਇੱਕ ਸਮੇਂ ਤੇ ਇਹ ਚੀਜ਼ ਭੁੱਲ ਜਾਂਦਾ ਕਿ ਸਾਨੂੰ ਕੋਈ ਦੁੱਖ ਸੀ ਕਿਉਂਕਿ ਭੰਗੜਾ ਇੱਕ ਅਜਿਹਾ ਉਹ ਐ ਕਿ ਜੋ ਕੀ ਸਾਡੇ ਮਨ ਨੂੰ ਮਨ ਨੂੰ ਵੀ ਤੇ ਸਾਡੇ ਮਾਨਸਿਕ ਸਿਹਤ ਨੂੰ ਵੀ ਬਹੁਤ ਜਿਆਦੇ ਬਹੁਤ ਜਿਆਦੇ ਉਤਸ਼ਾਹਿਤ ਕਰਦਾ ਕਿ ਭੰਗੜੇ ਨਾਲ ਸਾਡੇ ਸਾਰੇ ਸਟਰੈਸ ਰਲੀਫ ਹੋ ਜਾਂਦੇ ਨੇ ਠੀਕ ਐ ਤੇ ਇਤੋਂ ਬਾਅਦ ਜੇਕਰ ਅਸੀਂ ਭਾਵਨਾਤਮਿਕ ਤੰਦਰੁਸਤੀ ਦੀ ਗੱਲ ਕਰੀਏ ਤਾਂ ਭਾਵਨਾਵਾਂ ਪੰਜਾਬ ਦੇ ਵਿੱਚ ਰਹਿਣ ਕਰਕੇ ਪੰਜਾਬੀਆਂ ਦੀਆਂ ਜ਼ਿਆਦਾਤਰ ਭਾਵਨਾਵਾਂ ਭੰਗੜੇ ਨਾਲ ਜੁੜੀਆਂ ਹੁੰਦੀਆਂ ਹਨ ਇਹ ਜਿੱਦਾਂ ਕੀ ਹਰ ਇੱਕ ਮੇਲੇ ਤੇ ਜਿੱਦਾਂ ਕੀ ਵਿਸਾਖੀ ਦੇ ਮੇਲੇ ਤੇ ਭੰਗੜਾ ਪਾਇਆ ਜਾਂਦਾ ਇਸ ਦੇ ਵਿੱਚ ਜਿੱਦਾਂ ਕਿ ਗੱਭਰੂਆਂ ਦੇ ਕੁੜਤਾ ਪਜ਼ਾਮਾ ਤੁਰਲੇ ਵਾਲੀ ਪੱਗ ਆਦਿ ਇਨਾ ਤੇ ਹੋਰ ਨਾਲ ਸਾਜਾ ਨਾਲ ਇਹਨਾਂ ਦਾ ਮਤਲਬ ਪੇਸ਼ਕਾਰੀ ਕੀਤੀ ਜਾਂਦੀ ਐ ਭੰਗੜੇ ਦੀ ਭੰਗੜਾ ਕਿਉਂਕਿ ਇੱਕ ਅਜਿਹਾ ਗਾ ਜਿਸ ਦੇ ਵਿੱਚ ਵੀ ਮਤਲਬ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਵੀ ਭੰਗੜੇ ਨੂੰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦਾ ਆਨੰਦ ਮਾਣਦੇ ਨੇ ਅੱਜ ਕੱਲ ਤਾਂ ਸਕੂਲਾਂ ਦੇ ਵਿੱਚ ਵੀ ਭੰਗੜੇ ਦੇ ਟਰੇਨਰ ਰੱਖੇ ਜਾਂਦੇ ਨੇ ਜਿਸ ਕਰਕੇ ਸਪੈਸ਼ਲੀ ਭੰਗੜਾ ਬੱਚਿਆਂ ਨੂੰ ਸਿਖਾਇਆ ਜਾਂਦਾ ਤਾਂ ਜੋ ਕਿ ਪੰਜਾਬ ਵਿੱਚ ਰਹਿਣ ਨਾਲ ਇਕੱਲਾ ਪੰਜਾਬ ਦੇ ਵਿੱਚ ਹੀ ਨਹੀਂ ਬਾਕੀ ਇੰਡੀਆ ਦੇ ਸਾਰੇ ਸਟੇਟਾਂ ਦੇ ਵਿੱਚ ਇਸ ਬਾਰੇ ਪਤਾ ਚੱਲ ਲੱਗ ਸਕੇ ਤਾਂ ਕੀ ਬੱਚੇ ਵੱਧ ਤੋਂ ਵੱਧ ਇਸ ਚੀਜ਼ ਬਾਰੇ ਉਤਸ਼ਾਹਿਤ ਹੋਣ ਤੇ ਜ਼ਿਆਦਾਤਰ ਲੜਕੀਆਂ ਲੜਕੀਆਂ ਲਈ ਵੀ ਭੰਗੜਾ ਅੱਜ ਕੱਲ ਤਾਂ ਲੜਕੀਆਂ ਲਈ ਵੀ ਭੰਗੜਾ ਬਹੁਤ ਜਿਆਦੇ ਫੇਮਸ ਹੈ ਕਿਉਂਕਿ ਲੜਕੀਆਂ ਨੂੰ ਵੀ ਬਹੁਤ ਫੇਮਸ ਹੈ ਕਿਉਂਕਿ ਲੜਕੀਆਂ ਨੂੰ ਵੀ ਬਹੁਤ ਉਤਸਾਹਿਤ ਕਰਦੇ ਲੜਕੀਆਂ ਦੀ ਮਸ਼ਹੂਰ ਡਰੈਸ ਕੁਰਤਾ ਪ ਸਲਵਾਰ ਸੂਟ ਹੁੰਦੀ ਹੈ ਜਿਸ ਨਾਲ ਕੀ ਉਹ ਉਹਨਾਂ ਦੇ ਵੱਖਰੇ ਵੱਖਰੇ ਗਹਿਣੇ ਹੁੰਦੇ ਨੇ ਜਿੱਦਾਂ ਕੀ ਸੱਗੀ ਫੁੱਲ ਕੈਂਠੇ ਤੇ ਕੰਨਾਂ ਦੇ ਵਿੱਚ ਪਾਉਣ ਵਾਲੇ ਅਤੇ ਹੋਰ ਕਾਫੀ ਸਾਰੇ ਗਹਿਣੇ ਹੁੰਦੇ ਨੇ ਜੋ ਲੜਕੀਆਂ ਪਾਉਂਦੀਆਂ ਨੇ ਤੇ ਇਹਨਾਂ ਨਾਲ ਭੰਗੜੇ ਨੂੰ ਹੋਰ ਵੀ ਮਤਲਬ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਂਦਾ